ਸੱਭਿਆਚਾਰਕ ਜੋ ਤਿਉਹਾਰ ਹਨ ਪੰਜਾਬ ਵਿੱਚ ਜਿਹਨਾਂ ਵਿੱਚ ਕਿ ਮੁੱਖ ਤੌਰ 'ਤੇ ਜੋ ਸਿੱਖ ਧਰਮ ਵਿੱਚ ਸੱਭਿਆਚਾਰਕ ਤਿਉਹਾਰ ਵੀ ਕਹਿ ਸਕਦੇ ਹਾਂ ਜਾਂ ਸਮਾਗਮ ਵੀ ਕਹਿ ਸਕਦੇ ਹਾਂ ਹੋਲੇ ਮਹੱਲੇ ਦਾ ਹੁੰਦਾ ਹੈ ਜੋ ਕਿ ਸਾਰੇ ਪੰਜਾਬ ਵਿੱਚ ਬੜੇ ਚਾਅ ਨਾਲ ਮਨਾਇਆ ਜਾਦਾ ਹੈ ਹਿੰਦੂ ਧਰਮ ਵਿੱਚ ਇਸਨੂੰ ਹੋਲੀ ਕਹਿੰਦੇ ਹਨ ਅਤੇ ਸਿੱਖ ਧਰਮ ਵਿੱਚ ਹੋਲਾ ਮਹੱਲਾ ਦੇ ਨਾਮ 'ਤੇ ਮਨਾਇਆ ਜਾਂਦਾ ਹੈ ਉਸ ਦਿਨ ਅਸੀਂ ਵੀ ਬਾਕੀ ਸਾਰੇ ਸਿੱਖਾਂ ਵਾਂਗ ਸਵੇਰੇ ਉੱਠ ਕੇ ਨਹਾ ਧੋ ਕੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਤੇ ਦਿਨ ਵਿੱਚ ਬਾਅਦ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਜੋ ਕਿ ਅਨੰਦਪੁਰ ਸਾਹਿਬ ਵਿਖੇ ਗਤਕਾ ਖੇਲਦੀਆਂ ਹਨ ਉਹਨਾਂ ਦੇ ਕੌਤਕਾਂ ਦਾ ਅਸੀਂ ਆਨੰਦ ਮਾਣਦੇ ਹਾਂ ਕਿਉਂਕਿ ਉੱਥੇ ਉਹਨਾਂ ਵੱਲੋਂ ਜੋ ਸ਼ਸਤਰ ਦੀ ਸਿਖਲਾਈ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਸਦਾ ਉਹ ਵਿਖਾਵਾ ਕਰਦੇ ਹਨ ਉਹ ਵੀ ਇੱਕ ਵਿਲੱਖਣ ਕਲਾ ਹੈ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਪਰਿਵਾਰ ਦੇ ਦੋਸਤਾਂ ਮਿੱਤਰਾਂ ਨਾਲ਼ ਮਿਲ ਕੇ ਰਿਸ਼ਤੇਦਾਰਾਂ ਨਾਲ ਮਿਲ ਕੇ ਇੱਕ ਦੂਜੇ ਨੂੰ ਰੰਗ ਵੀ ਲਗਾਉਂਦੇ ਹਾਂ ਅਤੇ ਸਾਡੇ ਘਰਾਂ ਵਿੱਚ ਉਸ ਦਿਨ ਪੂਰਾ ਤਿਉਹਾਰ ਵਾਲਾ ਮਾਹੌਲ ਹੁੰਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਇਸ ਤੋਂ ਇਲਾਵਾ ਤੀਆਂ ਦਾ ਤਿਉਹਾਰ ਵੀ ਜੋ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਇਸ ਵਿੱਚ ਜੋ ਲੜਕੀਆਂ ਪਿੰਡ ਵਿੱਚ ਇੱਕਠੀਆਂ ਹੋ ਕੇ ਪੀਘਾਂ ਪਾ ਕੇ ਝੂਟਦੀਆਂ ਹਨ ਅਤੇ ਜੋ ਵਿਆਹੀਆਂ ਹੋਈਆਂ ਲੜਕੀਆਂ ਹਨ ਉਹ ਵੀ ਆਪਣੇ ਪੇਕੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ